ਭਾਰਤ ਦੀ ਰਾਜਧਾਨੀ ਅੰਗਰੇਜ਼ਾਂ ਦੇ ਵੇਲੇ ਤੋਂ ਚਲਦੀ ਆ ਰਹੀ ਹੈ ਕਿਸੇ ਵੇਲੇ ਬਹੁਤ ਵਧੀਆ ਵੀ ਹੁੰਦੀ ਹੈ ਅਤੇ ਕਿਸੇ ਵੇਲੇ ਬਹੁਤ ਨੀਵੇਂ ਪੱਧਰ 'ਤੇ ਵੀ ਆ ਜਾਂਦੀ ਹੈ ਪਰ ਇਹਨਾਂ ਬਾਰੇ ਕੁਛ ਵੀ ਕਹਿ ਸਕਣਾ ਮੁਸ਼ਕਲ ਹੈ ਕਿ ਇਹ ਕਿਵੇਂ ਚਲਦੀਆਂ ਹਨ ਜਿਹੜੀ ਪਾਰਟੀਬਾਜ਼ੀ ਆ ਜਾਂਦੀ ਹੈ ਰਾਜਨੀਤੀ ਦੇ ਵਿੱਚ ਉਹਦੇ ਨਾਲ ਨੁਕਸਾਨ ਕਿਸੇ ਹੋਰ ਦਾ ਨਹੀਂ ਹੁੰਦਾ ਆਮ ਜਨਤਾ ਦਾ ਹੁੰਦਾ ਹੈ ਆਮ ਜਨਤਾ ਇਹਨਾਂ ਦੇ ਵਿਚਕਾਰ ਫਸਦੀ ਜਾਂਦੀ ਹੈ ਲੋਕਤੰਤਰ ਦੇ ਵਿੱਚੋਂ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਪਸੰਦ ਹੈ ਉਹ ਇਹ ਆ ਕਿ ਅਸੀਂ ਆਪਣੇ ਆਪਣੇ ਆਪ ਦੇ ਆਪਣੇ ਰਾਈਟ ਲਈ ਅਸੀਂ ਬੋਲ ਸਕਦੇ ਹਾਂ ਅਸੀਂ ਆਪਣੇ ਲਈ ਕੁਛ ਵੀ ਮੁਸ਼ਕਲ ਹੋਵੇ ਉਹ ਅਸੀਂ ਖੁੱਲ੍ਹੇਆਮ ਕਹਿ ਸਕਦੇ ਹਾਂ ਪਰ ਨਾ ਪਸੰਦ ਇੱਥੇ ਆ ਜਾਂਦਾ ਹੈ ਜਦੋਂ ਕਿ ਸਾਡੀ ਪ੍ਰੋਬਲਮ ਨੂੰ ਸੁਣਨ ਤੋਂ ਬਾਅਦ ਵੀ ਉਹਦਾ ਕੋਈ ਨਤੀਜਾ ਨਹੀਂ ਕੱਢਿਆ ਜਾਂਦਾ ਅਤੇ ਸਾਡੀਆਂ ਪ੍ਰੋਬਲਮ ਉੱਥੇ ਦੀਆਂ ਉੱਥੇ ਖੜ੍ਹੀਆਂ ਰਹਿ ਜਾਂਦੀਆਂ ਹਨ ਜੇ ਕਿਸੇ ਰਾਜਨੀਤੀ ਨੇਤਾ ਨੂੰ ਮਿਲਣ ਦਾ ਮੈਨੂੰ ਕਦੀ ਮੌਕਾ ਲੱਗੇਗਾ ਤਾਂ ਇਸ ਦੇਸ਼ ਦੇਸ਼ ਦੇ ਭਵਿੱਖ ਨੂੰ ਸੁਧਾਰਨ ਲਈ ਉਹਨੂੰ ਜ਼ਰੂਰ ਪੁੱਛਾਂਗੀ ਕਿ ਇਸ ਤਰ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਆ ਕੇ ਤੁਹਾਡੀਆਂ ਸਿਆਸੀ ਪਾਰਟੀਆਂ ਦੇ ਵਿੱਚ ਜੋ ਨੁਕਸਾਨ ਆਮ ਜਨਤਾ ਦਾ ਸਾਡੇ ਵਰਗੀ ਆਮ ਜਨਤਾ ਦਾ ਹੁੰਦਾ ਉਹਨਾਂ ਦਾ ਉਹਨਾਂ ਬਾਰੇ ਕੀ ਵਿਚਾਰ ਹੈ ਕਿ ਉਹ ਆਪਣੀ ਆਪਸੀ ਲੜਾਈ ਦੇ ਵਿੱਚ ਸਾਡਾ ਆਮ ਜਨਤਾ ਦਾ ਕਿਉਂ ਨੁਕਸਾਨ ਕਰਦੇ ਹਨ ਉਹਨਾਂ ਨੂੰ ਇਹਨਾਂ ਚੀਜ਼ਾਂ ਵੱਲ ਨਾ ਧਿਆਨ ਦੇ ਕੇ ਇੱਕ ਦੂਜੇ ਦੇ ਵਿਰੋਧ 'ਚ ਨਾ ਬੋਲ ਕੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਜਨਤਾ ਦੀ ਬਣਾਈ ਹੋਈ ਸਰਕਾਰ ਜਨਤਾ ਦਾ ਕੋਈ ਫਾਇਦਾ ਕਰ ਸਕੇ